ਗ੍ਰਹਿ ਤਾਰਿਆਂ ਦੇ ਵਿੱਚੋਂ ਮੈਨੂੰ ਸੂਰਜ ਸਭ ਤੋਂ ਚੰਗਾ ਲੱਗਦਾ ਹੈ ਕਿਉਂਕਿ ਇਸਦੇ ਸਵੇਰੇ ਆਉਣ ਨਾਲ਼ ਹੀ ਘਰ ਦੇ ਵਿੱਚ ਸਾਰੇ ਚੰਗੇ ਕੰਮ ਸ਼ੁਰੂ ਹੋ ਜਾਂਦੇ ਹਨ ਹਰ ਬੰਦਾ ਆਪਣੇ ਕੰਮ ਕਾਰਾਂ ਵਿੱਚ ਲੱਗ ਜਾਂਦਾ ਹੈ ਅਤੇ ਇਸਦੇ ਛਿਪਣ 'ਤੇ ਤੱਕ ਸਾਰੇ ਕੰਮ ਖਤਮ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਸੂਰਜ ਸਭ ਤੋਂ ਆਕਰਸ਼ਕ ਤਾਰਾ ਹੈ ਜੋ ਕਿ ਹਰ ਇੱਕ ਆਦਮੀ ਦੇ ਲਈ ਇੱਕ ਆਕਰਸ਼ਕ ਤਾਰਾ ਹੈ ਬਾਕੀ ਕੁਦਰਤ ਦੇ ਬਣਾਏ ਸਾਰੇ ਗ੍ਰਹਿਣ ਹੀ ਚੰਗੇ ਹਨ ਬਟ ਸੂਰਜ ਦੀ ਕੋਈ ਸੂਰਜ ਗ੍ਰਹਿਣ ਬਾਰੇ ਕੋਈ ਵੀ ਨਹੀਂ ਬੋਲਿਆ ਜਾ ਰਿਹਾ